ਹੈਲੋ ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵਧੀਆ ਵਧੀਆ ਹੋਰ ਕਿਆ ਚੀਜ਼ ਅੱਛਾ ਤੁਸੀਂ ਨਵੇਂ ਆਏ ਹੋ ਹੁਣ ਹਾਂਜੀ ਹਾਂਜੀ ਹਾਂਜੀ ਮੈਨੂੰ ਤਾਂ ਪੰਜ ਸਾਲ ਹੋ ਗਏ ਮੈਂ ਇੱਥੇ ਹੀ ਰਹਿ ਰਿਹਾ ਜੀ ਹਾਂਜੀ ਹਾਂਜੀ ਪੁੱਛੋ ਜੋ ਮਰਜ਼ੀ ਪੁੱਛੋ ਸਭ ਪਤਾ ਹੈ ਜੀ

ਅੱਛਾ ਕੋਈ ਗੱਲ ਨਹੀਂ ਤੁਸੀਂ ਮੈਂ ਕਹਿੰਦਾ ਨਵਾਂ ਹਾਂਜੀ ਹਾਂਜੀ ਨਵਾਂਸ਼ਹਿਰ ਬੱਸ ਸਟੈਂਡ ਸੈਡ ਰਹਿੰਦੇ ਤੁਸੀਂ ਅੱਛਾ ਅੱਛਾ ਉੱਥੇ ਤਾਂ ਨੇੜੇ ਤੇੜੇ ਬਹੁਤ ਨੇ ਜੀ ਜਦੋਂ ਤੁਸੀਂ ਬੱਸ ਸਟੈਂਡ ਤੋਂ ਆਉਂਦੇ ਚੰਡੀਗੜ੍ਹ ਰੋਡ 'ਤੇ ਨੂੰ ਚੰਡੀਗੜ੍ਹ ਰੋਡ 'ਤੇ ਆਉਂਦਿਆ ਨੂੰ ਜਿਹੜਾ ਕੈਪੀਟਲ ਬੈਂਕ ਹੈਗਾ ਉਹ ਕੈਪੀਟਲ ਬੈਂਕ ਦੇ ਨਾਲ ਅੰਦਰ ਗਲੀ 'ਚ ਜਾ ਕੇ ਸਬਜ਼ੀ ਦੀਆਂ ਦੁਕਾਨਾਂ ਹੀ ਆ ਸਾਰੀਆਂ ਬਹੁਤ ਵਧੀਆ ਸਬਜ਼ੀ ਹੁੰਦੀ ਜੀ ਉਹਨਾਂ ਕੋਲ ਹਾਂਜੀ ਹਾਂਜੀ ਕੋ ਕੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਅੱਜ ਫ੍ਰੀ ਹੈ ਜੀ ਮੈਂ ਆ ਜਾਉਂਗਾ ਜੀ ਹਾਂਜੀ ਕੋ ਤੁਸੀਂ ਦੱਸੋ ਕਿੰਨੇ ਵਜੇ ਮੈਂ ਪਹੁੰਚਾ ਮੈਂ ਤਾਂ ਪੰਜ ਵਜੇ ਤੱਕ ਸ਼ਾਮ ਤੱਕ ਫ੍ਰੀ ਹੈ ਜਦੋਂ ਤੁਸੀਂ ਕਹੁੰਗੇ ਆ ਜਾਉਂਗਾ ਮੈਂ ਚ ਕੋਈ ਗੱਲ ਨਹੀਂ ਜਦੋਂ ਤੁਸੀਂ ਜਾਣਾ ਹੋਇਆ ਪਹੁੰਚ ਘਰ ਤੋਂ ਬਾਹਰ ਨਿਕਲਣਾ ਹੋਇਆ ਮੈਨੂੰ ਫ਼ੋਨ ਕਰ ਦਿਓ ਮੈਂ ਤੁਹਾਡੇ ਘਰ ਦੇ ਨੇੜੇ ਹੀ ਹਾਂ ਉੱਥੇ ਰਹਿੰਦਾ ਉੱਥੇ ਆ ਜਾਉਂਗਾ ਮੈਂ ਕਿੰਨੇ ਕੁ ਕਿੰਨੇ ਕੁ ਦਿਨ ਹੋਏ ਤੁਹਾਨੂੰ ਇੱਥੇ ਆਇਆ ਨੂੰ ਅੱਛਾ ਪਹਿਲਾਂ ਕਿੱਥੇ ਰੋਪੜ ਰਹਿੰਦੇ ਸੀ ਅੱਛਾ ਅੱਛਾ ਕੀ ਜੌਬ ਕਰਦੇ ਹੈ ਜ਼ਾਂ ਕੀ ਕਰਦੇ ਠੀਕ ਠੀਕ ਹੈ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਕੋਈ ਵੀ ਲੋੜ ਹੁੰਦੀ ਹੈ ਦੱਸ ਦਿਆ ਕਰੋ ਮੈਂ ਤਾਂ ਵੈਸੇ ਫ੍ਰੀ ਹੀ ਹੁੰਦਾ ਹਾਂ ਵਿਹਲਾ ਹੀ ਹਾਂ ਘਰ ਹੀ ਹੁੰਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹੋਰ ਬਾਕੀ ਜੇ ਕੱਪੜੇ ਲੈਣੇ ਹੋਵੇ ਕੁਛ ਹੋਰ ਸਮਾਨ ਜਦੋਂ ਮਰਜ਼ੀ ਦੱਸ ਦਿਓ ਦੁਕਾਨਾਂ ਹੈਗੀਆਂ ਆ ਠੀਕ ਹੈ ਜੀ ਫ਼ੋਨ ਕਰ ਦਿਓ ਮੈਂ ਪਹੁੰਚ ਜਾਉਂਗਾ ਉਨ੍ਹੇ ਟਾਈਮ 'ਤੇ ਠੀਕ ਹੈ ਜੀ ਓਕੇ ਓਕੇ